ਮੋਹਾਲੀ ਜ਼ਿਲ੍ਹੇ ਵਿੱਚ ਕੁਝ ਮਹੱਤਵਪੂਰਨ ਸਥਾਨ ਹਨ ਜਿਹਨਾਂ ਵਿੱਚੋਂ ਮੰਦਰ ਕਿਲ੍ਹੇ ਅਜਾਇਬ ਘਰ ਜਾਂ ਕੁਦਰਤੀ ਵਿਸ਼ੇਸ਼ਤਾਵਾਂ ਵੀ ਹਨ ਪਰ ਅਸੀਂ ਅਕਸਰ ਮੰਦਰ ਦੀ ਇੱਥੇ ਗੱਲ ਕਰਦੇ ਹਾਂ ਮੰਦਰ ਗੁਰਦੁਆਰਿਆਂ ਦੀ ਗੱਲ ਕਰਦੇ ਹਾਂ ਮੰਦਰ ਵਿੱਚ ਜਾਣ ਦੇ ਲਈ ਸਾਨੂੰ ਕਿਸੇ ਵੀ ਧਰਮ ਦੀ ਜਾਤ ਦੀ ਮਤਲਬ ਕੋਈ ਵੀ ਲੋੜ ਨਹੀਂ ਹੈ ਅਸੀਂ ਸਿਰਫ਼ ਕੀ ਹੈ ਆਪਣੀ ਅਵਸਥਾ ਵਿੱਚ ਆਪਣੇ ਮਨ ਦੀ ਅਵਸਥਾ ਬਿਆਨ ਕਰਨ ਵਾਸਤੇ ਆਪਣੇ ਦੁੱਖ ਸੁੱਖ ਜਾਂ ਆਪਣੀਆਂ ਯਾਦਾਂ ਨੂੰ ਯਾਦ ਕਰਨ ਵਾਸਤੇ ਅਸੀਂ ਮੰਦਰ ਗੁਰਦੁਆਰਿਆਂ ਵਿੱਚ ਜਾ ਸਕਦੇ ਹਾਂ ਕਿਉਂਕਿ ਇੱਥੇ ਸਭ ਤੋਂ ਜ਼ਿਆਦਾ ਇਹ ਅਹਿਮੀਅਤ ਹੈ ਕਿ ਨਾ ਤਾਂ ਸਾਡੀ ਦਾ ਜਾਤ ਪੁੱਛੀ ਜਾਂਦੀ ਹੈ ਨਾ ਸਾਡਾ ਧਰਮ ਪੁੱਛਿਆ ਜਾਂਦਾ ਹੈ ਨਾ ਸਾਨੂੰ ਕੋਈ ਸਾਡਾ ਪੁੱਛਿਆ ਜਾਂਦਾ ਕਿ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੈਗੇ ਹੋ ਅਤੇ ਸਾਨੂੰ ਇਸ ਵਿੱਚ ਕੋਈ ਵੀ ਸਾਨੂੰ ਪ੍ਰੋਬਲਮ ਨਹੀਂ ਆਉਂਦੀ ਹੈਗੀ ਅਸੀਂ ਆਪਣੇ ਮਨ ਦੀਆਂ ਅਵਸਥਾਵਾਂ ਕਿਸੇ ਬਿਨਾਂ ਸ਼ੇਅਰ ਕੀਤੇ ਬਿਨਾਂ ਕਿਸੇ ਘਰ ਦੇ ਇਨਸਾਨ ਨਾਲ਼ ਅਸੀਂ ਐਵੇਂ ਹੀ ਜਾ ਕੇ ਮੰਦਰ ਜਾਂ ਗੁਰਦੁਆਰੇ ਵਿੱਚ ਜਾ ਕੇ ਮੱਥਾ ਟੇਕ ਸਕਦੇ ਹਾਂ ਪਰਮਾਤਮਾ ਨੂੰ ਆਪਣੇ ਨਾਲ਼ ਅਸੀਂ ਸਿੱਧਾ ਹੀ ਵਾਰਤਾਲਾਪ ਕਰ ਸਕਦੇ ਹਾਂ ਬਿਨਾਂ ਕਿਸੇ ਨੂੰ ਸੁਣਾਏ ਜਾਂ ਬਿਨਾਂ ਕਿਸੇ ਨੂੰ ਦੱਸੇ ਅਸੀਂ ਕੁਝ ਵੀ ਅਸੀਂ ਪਰਮਾਤਮਾ ਦੇ ਅੱਗੇ ਆਪਣੇ ਅਰਦਾਸ ਕਰ ਸਕਦੇ ਹਾਂ ਜਿਸ ਨਾਲ਼ ਕਿ ਸਾਨੂੰ ਪੂਰੀ ਆਸ ਹੁੰਦੀ ਹੈ ਸਾਡੇ ਮਨ ਵਿੱਚ ਇਹ ਆਸਾਂ ਨਾਲ਼ ਭਰਿਆ ਹੁੰਦਾ ਕਿ ਅਸੀਂ ਜੇਕਰ ਜਾ ਕੇ ਪਰਮਾਤਮਾ ਕੋਲੋਂ ਮੰਗਾਂਗੇ ਤਾਂ ਸਾਡੀ ਉਹ ਹਮੇਸ਼ਾਂ ਸਾਡੀ ਦੁਆ ਉਹ ਪੂਰੀ ਕਰਦਾ ਹੈ ਅਤੇ ਇਹ ਇੱਕ ਲੋਕ ਸੱਚ ਵੀ ਹੈ ਕਿ ਸਾਡੀ ਸਾਰੀਆਂ ਇੱਛਾਵਾਂ ਜਿਹੜੀਆਂ ਹੈਗੀਆਂ ਉਹ ਪਰਮਾਤਮਾ ਹੀ ਪੂਰੀਆਂ ਕਰਦਾ ਹੈ ਅਤੇ ਅਕਸਰ ਕਿਹਾ ਜਾਂਦਾ ਹੈ ਕਿ ਰੱਬ ਤੋਂ ਮੰਗੋ ਨਾ ਕਿ ਇਨਸਾਨ ਕੋਲੋਂ ਮੰਗੋ ਕਿਉਂਕਿ ਇਨਸਾਨ ਜਦੋਂ ਸਾਨੂੰ ਕੁਝ ਨਹੀਂ ਦੇ ਸਕਦਾ ਪਰਮਾਤਮਾ ਇੱਕ ਇਹੋ ਜਿਹਾ ਮਤਲਬ ਉਹ ਰੂਪ ਹੈ ਪਰਮਾਤਮਾ ਇੱਕ ਇਹੋ ਜਿਹਾ ਸਾਡੇ ਮਨ ਦੀ ਅਵਸਥਾ ਨੂੰ ਬਿਆਨ ਕਰਨ ਵਾਲਾ ਇੱਕ ਇਹੋ ਜਿਹਾ

ਕਿਉਂਕਿ ਸਾਡੇ ਜਿਹੜਾ ਪੰਜਾਬ ਦੇ ਵਿੱਚ ਹੈਗੇ ਗੁਰਦੁਆਰੇ ਮੰਦਰ ਇੱਥੇ ਇਹਨਾਂ ਦੀ ਇੱਕ ਮਹੱਤਵਪੂਰਨ ਇਹੀ ਮਤਲਬ ਚ ਮਹੱਤਵਪੂਰਨ ਇੱਕ ਜੇਕਰ ਅਸੀਂ ਕਹਿ ਲਈਏ ਕਿ ਮਹੱਤਵਪੂਰਨ ਜ ਜ ਜਿਵੇਂ ਕਿ ਇੱਕ ਮਤਲਬ ਉਹ ਸ਼ਬਦ ਮੈਨੂੰ ਯਾਦ ਨਹੀਂ ਆ ਰਿਹਾ ਕਿ ਇੱਕ ਵਿਸ਼ੇਸ਼ਤਾ ਇਹ ਹੈਗੀ ਹੈ ਕਿ ਇੱਥੇ ਸਾਨੂੰ ਬਿਨਾਂ ਸਾਡੇ ਪਹਿਰਾਵੇ ਤੋਂ ਮਤਲਬ ਜਾਣੇ ਬਿਨਾਂ ਹੈ ਨਾ ਸਾਡੇ ਜਾਂ ਅਸੀਂ ਕਿਸੇ ਵੀ ਧਰਮ ਦੇ ਨਾਲ਼ ਸੰਬੰਧਿਤ ਹੋਈਏ ਸਾਨੂੰ ਇਹੋ ਜਿਹੀ ਕੋਈ ਵੀ ਲੋੜ ਨਹੀਂ ਹੈ ਜਾਂ ਫਿਰ ਕਿਤੇ ਸਾਨੂੰ ਪੰਜੀਕਰਨ ਨਹੀਂ ਕਰਵਾਉਣਾ ਪੈਂਦਾ ਕਿ ਅਸੀਂ ਇਸ ਜਾਤ ਨਾਲ਼ ਸੰਬੰਧਿਤ ਹਾਂ ਤਾਂ ਹੀ ਅਸੀਂ ਮੰਦਰ ਗੁਰਦੁਆਰੇ 'ਚ ਕਿਉਂਕਿ ਅਸੀਂ ਕਿਸੇ ਹੋਰ ਚਲੇ ਜਾਈਏ ਕਿਸੇ ਜਿੱਦਾਂ ਯੂ ਪੀ ਵੱਲ ਚਲੇ ਜਾਈਏ ਉੱਥੇ ਕਿੱਦਾਂ ਹੈ ਨਾ ਇਨਸਾਨ ਦੇ ਉੱਤੇ ਕਿੰਨਾ ਬੁਰਾ ਹਾਲ ਹੋ ਰਿਹਾ ਹੈ ਪਰ ਸਾਡੇ ਪੰਜਾਬ ਦੇ ਵਿੱਚ ਜਿਹੜੇ ਇਹ ਸਾਡੇ ਮੰਦਰ ਕਿਲ੍ਹੇ ਮੰਦਰ ਗੁਰਦੁਆਰੇ ਨੇ ਇਹ ਇਹਨਾਂ ਪੱਖੋਂ ਬਹੁਤ ਹੀ ਵਧੀਆ ਅਤੇ ਸਹਾਰਨੀਏ ਹਨ ਅਤੇ ਕਾਫ਼ੀ ਸਾਡੇ ਮਨ ਦੇ ਨੇੜੇ ਹਨ ਅਤੇ ਅਸੀਂ ਇਹਨਾਂ ਨੂੰ ਕਾਫ਼ੀ ਪੂਜਨਯੋਗ ਹਨ